ਪੰਜਾਬ ਦੇ ਜਿਹੜੇ ਪ੍ਰਸਿੱਧ ਰੈਸਟੋਰੈਂਟ ਨੇ ਉਹ ਹਵੇਲ ਹਵੇਲੀ ਕਲਾਂ ਅਤੇ ਢਾਬੇ ਢਾਬੇ ਹਨ ਅਤੇ ਜਿਹੜੇ ਸਾਡੇ ਸਟ੍ਰੀਟ ਫ਼ੂਡ ਨੇ ਉਹ ਦਹੀਂ ਭੱਲੇ ਗੋਲਗੱਪੇ 'ਚ ਟਿੱਕੀਆਂ ਆਦਿ ਆਦਿ ਹਨ ਅਤੇ ਜਿਹੜੇ ਸਾਡੇ ਰਵਾਇਤੀ ਫੂ ਪਕਵਾਨ ਨੇ ਉਹ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਹੀਂ ਆਦਿ ਹਨ